ਹੈਲੋ ਹੈਲੋ ਹਾਂਜੀ ਅਸੀਂ ਨਾ ਟੂਰਿਸਟ ਬੋਲਦੇ ਸੀ ਅਤੇ ਅਸੀਂ ਇੱਥੇ ਆਏ ਸੀ ਰਾਜਸਥਾਨ ਤੋਂ ਪੰਜਾਬ ਘੁੰਮਣ ਅਤੇ ਅਸੀਂ ਨਾ ਇੱਥੋਂ ਤੋਂ ਸਾਡੀ ਟਰੇਨ ਦਾ ਟਾਈਮ ਸੀਗਾ ਅਤੇ ਪਰ ਹਜੇ ਸਾਡੇ ਕੋਲ ਟਾਈਮ ਹੈਗਾ ਦੋ ਤਿੰਨ ਘੰਟਿਆਂ ਦਾ ਅਤੇ ਅਸੀਂ ਨਾ ਇੱਥੇ ਸਿਨਮਾ ਸੋਚਿਆ ਵੀ ਅਸੀਂ ਕੋਈ ਫਿਲਮ ਦੇਖ ਜੀਏ ਸਿਨਮੇ ਬਾਰੇ ਪੁੱਛ ਰਹੇ ਸੀ ਸਾਨੂੰ ਤੁਹਾਡਾ ਕਿਸੇ ਨੇ ਰੈਫਰੈਂਸ ਦਿੱਤਾ ਸੀ ਤੁਸੀਂ ਐਥੇ ਲੋਕਲ ਰਹਿੰਦੇ ਹੋ ਵਧੀਆ ਬੰਦੇ ਹੋ ਅਤੇ ਸਾਨੂੰ ਦੱਸੋਂਗੇ ਪਲੀਜ਼ ਵੀ ਕਿੱਥੇ ਕੁ ਹੈ ਸਿਨੇਮਾ ਅਤੇ ਕਿਹੜਾ ਵਧੀਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੈਗੇ ਹੈ ਜੀ ਤਿੰਨ ਚਾਰ ਘੰਟੇ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ

ਅਸੀਂ ਜੀ ਇਹ ਅਸੀਂ ਨਾ ਉੱਥੇ ਕਚਹਿਰੀ ਚੌਂਕ ਕੋਲ ਖੜ੍ਹੇ ਸੀ ਉੱਥੋਂ ਤੋਂ ਦੱਸੋ ਹੁਣ ਸਾਨੂੰ ਵੀ ਕਿੱਧਰ ਨੂੰ ਜਾਣਾ ਪਊ ਠੀਕ ਹੈ ਜੀ ਮੌਲ ਵਧੀਆ ਨਾ ਜੀ ਉਹ ਵਧੀਆ

ਅੱਛਾ ਅਤੇ ਹੋਰ ਕੀ ਕੀ ਫਸਿਲਟੀ ਉਹਦੇ ਵਿੱਚ ਮਾਲ 'ਚ ਸਿਨੇਮੇ 'ਚ ਫਿਲਮ ਦੇਖਣੀ ਠੀਕ ਹੈ ਤੁਸੀਂ ਖੇਚਲਾਂ ਕਰੋਗੇ ਇੱਥੇ ਤੱਕ ਕਚਹਿਰੀ ਚੌਂਕ ਆਉਣ ਦੀ ਠੀਕ ਹੈ ਜੀ ਚਲੋ ਠੀਕ ਹੈ ਥੈਂਕ ਯੂ